ਕਲਮਕਾਰੀ ਇਹ ਉਹ ਪੇਂਟਿੰਗ ਹੈ ਜੋ ਕਿ ਅਸੀਂ ਆਪਣੇ ਹੱਥ ਨਾਲ ਘੜਦੇ ਹਾਂ ਇਹ ਪੇਟਿੰਗ ਅਸੀਂ ਬਿਲਕੁਲ ਸਾਫ ਪੇਜ ਲੈ ਲੈਂਦੇ ਹਾਂ ਅਤੇ ਫਿਰ ਪੈਨਸਿਲ ਨਾਲ ਉਸ ਉੱਤੇ ਪੇਂਟਿੰਗ ਕਰਨੀ ਸ਼ੁਰੂ ਕਰ ਦਿੰਦੇ ਹਾਂ ਅਤੇ ਇਸ ਉੱਪਰ ਅਸੀਂ ਪੇਂਟਿੰਗ ਆਪਣੀ ਮਰਜ਼ੀ ਨਾਲ ਕਰਦੇ ਹਾਂ ਜੇਕਰ ਅਸੀਂ ਕਿਸੇ ਦੀ ਤਸਵੀਰ ਆਦਿ ਬਣਾਉਣੀ ਹੋਏ ਤਾਂ ਅਸੀਂ ਉਸ ਦੇ ਪੇਂਟਿੰਗ ਕਰਨੀ ਸ਼ੁਰੂ ਕਰ ਦਿੰਦੇ ਹਾਂ ਅਸੀਂ ਸਾਫ ਪੇਜ ਉੱਪਰ ਪੇਂਟਿੰਗ ਕਰਦੇ ਹਾਂ ਅਤੇ ਪੇਂਟਿੰਗ ਕਰਨ ਤੋਂ ਬਾਅਦ ਉਸਨੂੰ ਅਸੀਂ ਸਕੈਚ ਪੈਨ ਜਾਂ ਕਲਰ ਨਾਲ ਕਲਰ ਨਾਲ ਕਰ ਦਿੰਦੇ ਹਾਂ ਜੇਕਰ ਤਾਂ ਜੋ ਤਸਵੀਰ ਸਾਨੂੰ ਵਧੀਆ ਲੱਗੇ ਅਤੇ ਅਸੀਂ ਕਲਮਕਾਰੀ ਨਾਲ ਪੇਂਟਿੰਗ ਕਰਨ ਦੇ ਸਾਨੂੰ ਬਹੁਤ ਹੀ ਫਾਇਦੇ ਹਨ ਜੇਕਰ ਅਸੀਂ ਪੈਨਸਿਲ ਨਾਲ ਪੇਂਟਿੰਗ ਕੀਤੀ ਹੋਵੇ ਤਾਂ ਅਗਰ ਉਹ ਪੇਂਟਿੰਗ ਗਲਤ ਹੋ ਜਾਵੇ ਤਾਂ ਅਸੀਂ ਉਸ ਨੂੰ ਮਿਟਾ ਸਕਦੇ ਹਾਂ ਜਿਸ ਨਾਲ ਪੇਂਟਿੰਗ ਅਸੀਂ ਫਿਰ ਤੋਂ ਕਰ ਸਕਦੇ ਹਾਂ ਪਰ ਜਿੱਥੇ ਸਾਨੂੰ ਕਲਮਕਾਰੀ ਪੇਂਟਿੰਗ ਦੇ ਫਾਇਦੇ ਹਨ ਉੱਥੇ ਹੀ ਸਾਨੂੰ ਨੁਕਸਾਨ ਵੀ ਹਨ ਜੇਕਰ ਅਸੀਂ ਪੈਨਸਿਨ ਨਾਲ ਪੇਂਟਿੰਗ ਕੀਤੀ ਹੋਵੇਗੀ ਤਾਂ ਅਸੀਂ ਉਸਨੂੰ ਮਿਟਾ ਤਾਂ ਸਕਦੇ ਹਾਂ ਪਰ ਜੇਕਰ ਅਸੀਂ ਪੈਨ ਜਾਂ ਸਕੈਚ ਪੈਨ ਨਾਲ ਕੀਤੀ ਹੋਵੇਗੀ ਤਾਂ ਅਸੀਂ ਉਸਨੂੰ ਮਿਟਾ ਨਹੀਂ ਸਕਦੇ ਅਤੇ ਨਾ ਹੀ ਉਸਨੂੰ ਠੀਕ ਕਰ ਸਕਦੇ ਹਾਂ ਜੋ ਕਿ ਜਿਸ ਨਾਲ ਸਾਨੂੰ ਨੁਕਸਾਨ ਹੁੰਦਾ ਹੈ ਕਲਮਕਾਰੀ ਨਾਲ ਬਣਾਈ ਪੇਂਟਿੰਗ ਅਸੀਂ ਔਫਿਸ ਕੰਧਾਂ 'ਤੇ ਵੀ ਲਗਾ ਸਕਦੇ ਹਾਂ ਅਤੇ ਬਾਜ਼ਾਰ ਵਿੱਚ ਵੇਚ ਵੀ ਸਕਦੇ ਹਾਂ ਇਸ ਕਰਕੇ ਮੈਨੂੰ ਕਲਮਕਾਰੀ ਨਾਲ ਪੇਂਟਿੰਗ ਕਰਨਾ ਬਹੁਤ ਹੀ ਪਸੰਦ ਹੈ